ਸਤਿ ਸ੍ਰੀ ਅਕਾਲ ਸਰ ਜੀ ਹਾਂਜੀ ਸਰ ਹਾਂਜੀ ਸਰ ਦੱਸੋ ਜੀ ਠੀਕ ਹੈ ਸਰ ਠੀਕ ਹੈ ਸਰ ਹਾਂਜੀ ਸਰ ਉਹ ਤੋ ਮੈਂ ਸਵੇਰੇ ਰੋਜ਼ ਹੀ ਕਰਦਾ ਸਰ ਜੇ ਤੁਸੀਂ ਕਹਿ ਰਹੇ ਹੋ ਤਾਂ ਅੱਜ ਹੋਰ ਕਰਦਾਂਗੇ ਸਰ ਹਾਂਜੀ ਹਾਂਜੀ ਸਰ ਹਾਂਜੀ ਸਰ ਕੋਈ ਗੱਲ ਨਹੀਂ ਸਰ ਤੁਹਾਨੂੰ ਅੱਗੇ ਵੀ ਸਾਡੇ ਵੱਲੋਂ ਕੋਈ ਉਲਾਮਾ ਨਹੀਂ ਆਇਆ ਸਰ ਹੁਣ ਵੀ ਨਹੀਂ ਆਵੇਗਾ ਸਰ ਸਾਰਾ ਕੁਝ ਕੰਮ ਤੁਹਾਨੂੰ ਜਿਵੇਂ ਤੁਸੀਂ ਕਹੋਗੇ ਸਰ ਉਵੇਂ ਕਰਦਾਂਗੇ ਹਾਂਜੀ ਹਾਂਜੀ ਸਰ ਹਾਂਜੀ ਸਰ ਪਾਣੀ ਤਾਂ ਉਹ ਮਾਲੀ ਲਗਾ ਰਿਹਾ ਸਰ ਸਾਰੇ ਪੌਦਿਆ ਨੂੰ ਪਾਣੀ ਲੱਗਦਾ ਪ੍ਰੋਪਰ ਹਾਂਜੀ ਹਾਂਜੀ ਹਾਂਜੀ ਸਰ ਉਹ ਜੀ ਮੈਂ ਉਹ ਰਾਮ ਸਰ ਦੀ ਤਾਂ ਉਹਨਾਂ ਦੀ ਅਲਮਾਰੀ 'ਚ ਰੱਖਤੀ ਸੀ ਤੁਹਾਡੀ ਥੋ ਤੁਹਾਡੀ ਆਪ ਦੀ ਅਲਮਾਰੀ 'ਚ ਪਈ ਹੈ ਸਰ ਸਾਰੀਆਂ ਟੀਚਰਾਂ 'ਚ ਜਿਹਨੇ ਜਿਨ੍ਹਾਂ ਨੇ ਮੈਨੂੰ ਉਹ ਜਿਹੜੇ ਅਪ ਡਾਕੂਮੈਂਟ ਦਿੱਤੇ ਸੀ ਸਾਰੇ ਉਹਨਾਂ ਦੇ ਆਪੋ ਆਪ ਦੀ ਅਲਮਾਰੀ 'ਚ ਪਏ ਆ ਸਰ ਹਾਂਜੀ ਹਾਂਜੀ ਹਾਂਜੀ ਉਹ ਕੱਲ੍ਹ ਮਕੈਨਿਕ ਨੂੰ ਕਿਹਾ ਹੋਇਆ ਸੀ ਉਹ ਕਰ ਗਿਆ ਸਰ ਹਾਂ ਸਰ ਉਹਦਾ ਸੈਲ ਸੜਿਆ ਹੋਇਆ ਸੀ ਸਰ ਉਹਨੇ ਸੈ ਸੈੱਲ ਨਵਾਂ ਪਾਤਾ ਅਤੇ ਸਹੀ ਚੱਲ ਗਿਆ ਜੀ ਹਾਂਜੀ ਹਾਂਜੀ ਉਹ ਵੀ ਹੋ ਗਿਆ ਸਰ ਉਹਦੇ 'ਚ ਥੋੜ੍ਹਾ ਟੈਕਨੀਕਲ ਪ੍ਰੋਬਲਮ ਸੀ ਜੀ ਸਰ ਅਤੇ ਉਹ ਆਇਆ ਸੀ ਮੇਕ ਮਿਸਤਰੀ ਅਤੇ ਉਹ ਕਰ ਗਿਆ ਸਰ ਗਰੋਂਡ 'ਚ ਕਿਹੜੇ ਸਰ ਉਹ ਆਪਣੇ ਸਾਈਡ ਵਾਲੇ 'ਚ ਸਰ ਹਾਂਜੀ ਹਾਂਜੀ ਹਾਂਜੀ ਸਰ ਉਹ ਕੋਈ ਗੱਲ ਨਹੀਂ ਸਰ ਮੈਂ ਅੱਜ ਕਹਿ ਦਿਆਂਗਾ ਜਾਂ ਤਾਂ ਉਹ ਮੁੰਡਿਆਂ ਨੂੰ ਲਗਾ ਕੇ ਸਹੀ ਕਰਵਾ ਦਿਆਂ ਜਾਂ ਜਿੱਥੇ ਮਿੱਟੀ ਹੋਰ ਪੈਣ ਵਾਲੀ ਸਰ ਮਿੱਟੀ ਪਵਾ ਦਿੰਦੇ ਹਾਂ ਹਾਂਜੀ ਹਾਂਜੀ ਸਰ ਉਹ ਤੁਸੀਂ ਪਹਿਲਾਂ ਵੀ ਕਿਹਾ ਸੀ ਮੈਨੂੰ ਮੈਂ ਨਰਸਰੀ ਤੋਂ ਆਰਡਰ ਦਿੱਤਾ ਹੋਇਆ ਸਰ ਪੌਦਿਆਂ ਦਾ ਉਹ ਕਹਿੰਦੇ ਜਦੋਂ ਵੀ ਤੁਹਾਨੂੰ ਟਾਈਮ ਆਇਆ ਅਸੀਂ ਭੇਜਦਾਂਗੇ ਪੌਦੇ ਅਤੇ ਨਾਲ ਆਪਣਾ ਬੰਦਾ ਭੇਜ ਕੇ ਉਹ ਲਗਵਾ ਦੇਣੇ ਆ ਸਰ ਫਿਰ ਨਾਲ ਆਪਣਾ ਮਾਲੀ ਲੱਗਜੂਗਾ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਤੁਸੀਂ ਟੈਨਸ਼ਨ ਨਾ ਲਓ ਸਰ ਸਾਰਾ ਕੰਮ ਮੇਰੇ 'ਤੇ ਛੱਡ ਦਿਓ ਮੈਂ ਆਪਣੇ ਆਪ ਸੰਭਾਲ ਲਾਂਗਾ ਸਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਹੈ ਨਹੀਂ ਜੀ ਹਾਂਜੀ ਹਾਂਜੀ ਸਰ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ